ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਪਰੇਂਟਸ ਮੀਟਿੰਗ ਸੀ ਹਾਂਜੀ ਹਾਂ ਹਾਂਜੀ ਉਹ ਫਸਟ ਟੈਸਟ ਹੋਇਆ ਸੀ ਨਾ ਅਤੇ ਉਸ ਤੋਂ ਬਾਅਦ ਅਸੀਂ ਮੀਟਿੰਗ ਇਸ ਕਰਕੇ ਰੱਖੀ ਸੀ ਕਿ ਜਿਹੜੇ ਪਰੇਂਟਸ ਜਾਣ ਸਕਣ ਕਿ ਬੱਚੇ ਦੀ ਕੀ ਪੋਜੀਸ਼ਨ ਆ ਕਲਾਸ ਦੇ ਵਿੱਚ ਕਿਸ ਤਰ੍ਹਾਂ ਪੜ੍ਹ ਰਹੇ ਆ ਪਰਫੋਰਮੈਂਸ ਕਿਵੇਂ ਆ ਅਤੇ ਮੇਰੇ ਕੋਲ ਰਿਕੋਡ ਹੈਗਾ ਇਸਦਾ ਇੱਕ ਮਿੰਟ ਹੋਲਡ ਕਰਿਓ ਮੈਂ ਰਿਕੋਡ ਦੇਖ ਕੇ ਦੱਸਦਾ ਇਸਦਾ ਅਤੇ ਆਹ ਦੇਖੋ ਹਾਂਜੀ ਜਿਵੇਂ ਇਹਦੇ ਮਾਰਕਸ ਦਾ ਕਾਫੀ ਅੱਛੇ ਨੇ ਜਿਵੇਂ ਸਾਇੰਸ ਦੇ ਵਿੱਚ ਅੱਛੇ ਮਾਰਕਸ ਨੇ ਹੰਡਰਡ 'ਚੋਂ ਨਾਇਨਟੀ ਏਟ ਇੰਗਲਿਸ਼ ਵੀ ਇਸ ਤਰ੍ਹਾਂ ਦੀ ਨਾਇਨਟੀ ਏਟ ਐੱਸ ਐੱਸ ਨਾਇਨਟੀ ਸੈਵਨ ਪੰਜਾਬੀ ਕਿਉਂਕਿ ਲੈਂਗੁਏਜ ਜਾ ਕੇ ਬੱਚਿਆਂ ਦੇ ਇੰਨੇ ਕੁ ਹੀ ਆਉਂਦੇ ਆ ਨੱਬੇ ਨੰਬਰ ਬਹੁਤ ਅੱਛੇ ਨੰਬਰ ਨੇ ਜਾਣੀ ਟੋਪ ਪੇ ਇਹਦੇ ਤਾਂ ਮੇਰੇ ਹਿਸਾਬ ਨਾਲ ਜਿਵੇਂ ਮੈਥ ਮੈਂ ਕਰਾਉਦਾ ਇਹਨਾਂ ਨੂੰ ਅਤੇ ਕਲਾਸ ਟੀਚਰ ਵੀ ਹੈ ਅਤੇ ਮੈਂ ਮੈਥ ਵੀ ਮੈਂ ਹੀ ਕਰਾਉਨਾ ਇਹਨਾਂ ਨੂੰ ਇਸ ਦੇ ਵਿੱਚ ਇਹ ਕੁਛ ਨੰਬਰ ਹੋਰ ਵਧੀਆ ਲੈ ਸਕਦੇ ਹੰਡਰਡ ਆ ਸਕਦੇ ਸੀ ਕੁਛ ਸਿਲੀ ਮਿਸਟੇਕਸ ਕਰਕੇ ਨਾ ਜਿਵੇਂ ਕੈਲਕੂਲੇਸ਼ਨ ਮਿਸਟੇਕ ਹੋ ਜਾਂਦੀ ਹੈ ਬੱਚੇ ਕੋਲੋਂ ਜਲਦਬਾਜ਼ੀ ਕਰਨ ਦੇ ਵਿੱਚ ਹੈ ਨਾ ਜੀ ਉਹਦੇ ਕਰਕੇ ਨੰਬਰ ਕਟਾ ਗਿਆ ਇਹ ਪੰਜ ਨੰਬਰ ਬੇਸਿਕਲੀ ਪਤਾ ਤੁਹਾਨੂੰ ਕਿ ਮੈਂਥਮੈਟਿਕਸ ਦੇ ਵਿੱਚ ਬੇਸਿਕ ਤਾਂ ਕੈਲਕੂਲੇਸ਼ਨ ਦਾ ਹੀ ਹੈ ਨਾ ਹਾਂਜੀ ਹਾਂ ਕਿਉਂਕਿ ਇਹਨੂੰ ਕਹਿ ਦੇਵੇ ਘਰ ਨਾ ਮੈਨੂੰ ਐਂ ਵੀ ਲੱਗਦਾ ਕਿ ਕੈਲਕੂਲੇਟਰ 'ਤੇ ਨਾ ਕਰਦਾ ਹੋਵੇ ਕੈਲਕੂਲੇਸ਼ਨ ਜਦੋਂ ਇਹ ਪ੍ਰੈਕਟਿਸ ਕਰਦਾ ਹਾਂ ਮੇ ਬੀ ਜੋ ਟੈਸਟ ਦੇ ਕੋਲ ਨਾ ਬੱਚਾ ਸਿਲੇਬਸ ਕੰਪਲੀਟ ਕਰਨ ਦਾ ਮਾਰਾ ਨਾ ਉਹ ਕਰ ਦਿੰਦਾ ਕਿ ਮੈਂ ਜਲਦੀ ਹੋ ਜੂ ਸਿਲੇਬਸ ਚਲੋ ਕੈਲਕੂਲੇਟਰ ਨਾਲ ਕਰ ਦਿੰਦੇ ਹਾਂ ਵੀ ਸਮ ਜਲਦੀ ਹੋ ਜਾਣਗੇ ਬਸ ਆਹੀ ਪ੍ਰੋਬਲਮ ਇਹਦੀ ਮੈਨੂੰ ਲੱਗੀ ਬਾਕੀ ਤਾਂ ਇਹ ਓਵਰਆਲ ਵੀ ਠੀਕ ਹੈ ਓਬੀਡੀਐਂਟ ਵੀ ਹੈਗਾ ਕਲਾਸ ਦੇ ਵਿੱਚ ਇਸ ਤਰ੍ਹਾਂ ਕੋਈ ਨਹੀਂ ਹੈ ਮੈਨੂੰ ਕੋਈ ਜੇ ਐਂ ਨਹੀਂ ਹੋਇਆ ਵੀ ਤੁਸੀਂ ਆਏ ਨਹੀਂ ਵੀ ਕਾਹਤੇ ਨਹੀਂ ਆਏ ਹੈਗੇ ਪੇਰੈਂਟਸ ਕਿਉਂਕਿ ਕੋਈ ਉਲਾਂਬਾ ਨਹੀਂ ਸੀ ਇਹਦਾ ਕਿਉਂਕਿ ਇਹ ਪਰਫੋਰਮੈਂਸ ਅੱਛੀ ਹੈ ਬੱਚੇ ਦੀ ਅਤੇ ਹਾਂਜੀ ਚਲੋ ਤਾਂ ਹਾਂਜੀ ਅਸੀਂ ਵੀ ਸਮਝਦੇ ਹਾਂ ਵੈਸੇ ਵੀ ਅਸੀਂ ਨਾ ਘੱਟ ਹੀ ਉਹ ਕਰਦੇ ਜਿਹੜੇ ਬੱਚੇ ਦਾ ਹੁੰਦਾ ਨਾ ਵੀ ਰਿ ਰਿਕੋਡ ਸਹੀ ਹੁੰਦਾ ਸਾਨੂੰ ਪਤਾ ਵੀ ਕਿ ਪੇਰੈਂਟਸ ਧਿਆਨ ਦੇ ਰਹੇ ਨੇ ਪਹਿਲਾਂ ਤੋਂ ਹੀ ਅਤੇ ਚਲੋ ਵੀ ਜੇ ਆ ਜਾਂਦੇ ਤਾਂ ਵਧੀਆ ਹੁੰਦਾ ਨੈਕਸਟ ਟਾਈਮ ਤੁਸੀਂ ਫਿਰ ਨਾ ਕੋਸ਼ਿਸ਼ ਕਰਨੀ ਹੈ ਪੂਰੀ ਆਪਣੀ ਕਿ ਤੁਸੀਂ ਨੈਕਸਟ ਟਾਈਮ ਹਾਂਜੀ ਜਿਹੜੀ ਮੀਟਿੰਗ ਹੋਏਗੀ ਤੁਹਾਨੂੰ ਪਹਿਲਾਂ ਇਨਫੋਰਮ ਤਾਂ ਹੋ ਹੀ ਜਾਂਦਾ ਵਟਸਐਪ ਥਰੂ ਜਾਂ ਜਿਹੜਾ ਗਰੁੱਪ ਬਣਿਆ ਹੋਇਆ ਇਹਨਾਂ ਦਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਧੰਨਵਾਦ ਜੀ